ਮੇਰੇ ਅਨੁਸਾਰ ਜੋ ਭੰਗੜਾ ਐਰੋਬਿਕਸ ਨੂੰ ਲੈ ਕੇ ਲੋਕਾਂ ਵਿੱਚ ਸਭ ਤੋਂ ਵੱਡੀ ਗਲਤ ਧਾਰਨਾ ਹੈ ਉਹ ਇਹ ਹੈ ਕਿ ਇਹ ਸਿਰਫ ਪੰਜਾਬ ਦੇ ਲੋਕਾਂ ਲਈ ਹੀ ਹੈ ਅਤੇ ਇਸ ਨੂੰ ਸਿਰਫ ਔਰਤਾਂ ਲਈ ਹੀ ਬਣਾਇਆ ਗਿਆ ਹੈ ਇਹ ਦੋਨੋਂ ਹੀ ਧਾਰਨਾਵਾਂ ਬਹੁਤ ਗਲਤ ਹਨ ਭੰਗੜਾ ਐਰੋਬਿਕਸ ਸਾਰੇ ਹੀ ਕਿਸਮਾਂ ਅਤੇ ਧਰਮਾਂ ਦੇ ਲੋਕਾਂ ਲਈ ਹੈ ਜੋ ਜੋਸ਼ ਅਤੇ ਮਜ਼ਾ ਇਸ ਨੂੰ ਕਰਨ ਵਿੱਚ ਆਉਂਦਾ ਹੈ ਉਹ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਅਤੇ ਸਕੂਨ ਦਿੰਦਾ ਹੈ ਅਤੇ ਇਸ ਨੂੰ ਔਰਤ ਅਤੇ ਮਰਦ ਦੋਨੋਂ ਹੀ ਕਰ ਸਕਦੇ ਹਨ ਇੱਕ ਦੂਜੀ ਬਹੁਤ ਵੱਡੀ ਗਲਤ ਧਾਰਨਾ ਹੈ ਉਹ ਇਹ ਹੈ ਕਿ ਭੰਗੜਾ ਐਰੋਬਿਕਸ ਨੂੰ ਕਰਨ ਲਈ ਨਵੇਂ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਮੁਸ਼ਕਿਲ ਹੁੰਦੀ ਹੈ ਪਰ ਇੱਦਾਂ ਦਾ ਕੁਝ ਨਹੀਂ ਹੈ ਨਵੇਂ ਲੋਕਾਂ ਨੂੰ ਬਹੁਤ ਹੀ ਆਸਾਨ ਚਾਲਾਂ ਤੋਂ ਸ਼ੁਰੂਆਤ ਕਰਵਾਈ ਜਾਂਦੀ ਹੈ ਅਤੇ ਸਮੇਂ ਦੇ ਨਾਲ ਉਹਨਾਂ ਦਾ ਵਾਧਾ ਹੁੰਦਾ ਹੈ ਇਹ ਬਹੁਤ ਹੀ ਸਾਰੀਆਂ ਗਲਤ ਧਾਰਨਾਵਾਂ ਨੂੰ ਠੀਕ ਕਰਨ ਦੀ ਜ਼ਰੂਰਤ ਹੈ ਜਿੱਦਾਂ ਸਾਨੂੰ ਪਤਾ ਹੀ ਹੈ ਅੱਜ ਦਾ ਸਮੇਂ ਸੋਸ਼ਲ ਮੀਡੀਆ ਦਾ ਸਮਾਂ ਹੈ ਅਤੇ ਇਸ ਦੀ ਸਹਾਇਤਾ ਨਾਲ ਲੋਕਾਂ ਨੂੰ ਸਹੀ ਜਾਣਕਾਰੀ ਸਾਂਝਾ ਕੀਤੀ ਜਾ ਸਕਦੀ ਹੈ ਆਪਣੇ ਸਕੂਲ ਅਤੇ ਕਾਲਜਾਂ ਵਿੱਚ ਵਰਕਸ਼ਾਪਾਂ ਨਾਲ ਲੋਕਾਂ ਨੂੰ ਜਾਗਰੂਕ ਕਰ ਸਕਦੇ ਹਨ ਅਤੇ ਇਸ ਨਾਲ ਜਿੰਨੀਆਂ ਵੀ ਗਲਤ ਧਾਰਨਾ ਹੈ ਉਸ ਨੂੰ ਖਤਮ ਕੀਤਾ ਜਾ ਸਕਦਾ ਹੈ